ਹੈਲੋ ਹੈਲੋ ਸਤਿ ਸ਼੍ਰੀ ਅਕਾਲ ਮਲਹੋਤਰਾ ਜੀ ਬੂਕ ਡਿਪੋਰਟ ਤੋਂ ਬੋਲਦੇ ਪਏ ਹੋ ਮੈਨੂੰ ਆਪਣੇ ਮੈਨੂੰ ਬੁੱਕਸ ਕੁਛ ਬੁੱਕਸ ਖਰੀਦੀਆਂ ਸੀਗੀਆਂ ਤੁਹਾਡੇ ਸਟੋਰ 'ਚ ਕੁਝ ਜਸਟ ਡਿਸਕਸ਼ਨ ਕਰਨੀ ਸੀ ਕਿ ਪੁੱਛਣਾ ਸੀ ਕਿ ਇਹ ਅਵੇਲੇਬਲ ਹੋਣਗੀਆਂ ਜਾਂ ਨਹੀਂ ਹੋਣਗੀਆਂ ਲਾਈਕ ਮੈਂ ਗ੍ਰੈਜੂਏਸ਼ਨ ਫਸਟ ਈਅਰ ਦੀਆਂ ਜਿਹੜੀਆਂ ਬੁੱਕਸ ਆ ਉਹ ਲੈਣੀਆਂ ਅਤੇ ਤੁਹਾਨੂੰ ਤੁਹਾਡੀ ਸ਼ੋਪ 'ਤੇ ਅਵੇਲੇਬਲ ਹੋਣਗੀਆਂ ਲਾਇਕ ਮੈਥ ਮੈਥ ਦੀ ਲੈਣੀ ਹੈ ਕੰਪਿਊਟਰ ਦੀ ਲੈਣੀ ਹੈ ਫਿਜਿਕਸ ਦੀ ਉਹਦੇ ਵੀ ਅੱਗੇ ਵੀ ਸਬਪਾਰਟ ਹੈਗੇ ਆ ਮੈਥ ਦੇ ਦਾ ਹੈ ਰੀਅਲ ਐਨਲੈਲਸੀਸ ਹੈਗੀ ਹੈ ਅਤੇ ਫਿਜਿਕਸ ਦਾ ਕੋਆਨਟਮ ਫਿਜਿਕਸ ਅਤੇ ਕੰਪਿਊਟਰ ਹਾਂ ਤੁਹਾਡੇ ਸੈਕਿੰਡ ਹੈਂਡ ਅਵੇਲੇਬਲ ਹੈ ਅਤੇ ਠੀਕ ਹੈ ਕੰਪਿਊਟਰ ਦੀ ਕੋਈ ਨਾ ਮੈਂ ਨਵੀਆਂ ਲੈ ਲਊਗੀ ਅਤੇ ਤੁਸੀਂ ਮਤਲਬ ਕਿ ਕਿ ਕਿੰਨੇ ਪਰਸੈਂਟ ਤੱਕ ਦੇ ਦਓਗੇ ਲਾਇਕ ਕਿੰਨੇ ਪ੍ਰਾਈਸ 'ਤੇ ਦੇ ਦਓਗੇ ਸੈਕਿੰਡ ਹੈਂਡ ਬੁੱਕ ਠੀਕ ਹੈ ਅਤੇ ਤੁਸੀਂ ਜਿਹੜੀਆਂ ਪੁਰਾਣੀਆਂ ਬੁੱਕਸ ਹੈ ਉਹ ਲੈ ਸਕਦੇ ਹੋ ਲਾਇਕ ਤੁਸੀਂ ਖਰੀਦ ਪਲੱਸ ਟੂ ਦੀ ਸਾਇੰਸ ਦੀ ਬੂਕ ਦੀ ਕੰਡੀਸ਼ਨ ਵਧੀਆਂ ਹੈ ਲਾਇਕ ਕੋਈ ਫਟੀ ਵਟੀ ਨਹੀਂ ਹੈ ਜਾਂ ਕੋਈ ਪੇ ਪੰਨਾ ਵਿੱਚੋਂ ਕੋਈ ਪੇਜ ਵਗੈਰਾ ਕੋਈ ਨਿਕਲਿਆਂ ਨਹੀਂ ਹੋਇਆ ਉਵੇਂ ਕੰਡੀਸ਼ਨ ਬਿਲਕੁਲ ਠੀਕ ਹੈਗੀ ਐ ਓਕੇ ਹਾਂਜੀ ਮੈਂ ਤੁਹਾਨੂੰ ਮੈਂ ਤੁਹਾਨੂੰ ਵੱਟਸਐਪ ਕਰ ਦਊਗੀ ਪਿਕਸ ਬੁੱਕਸ ਦੀਆਂ ਹਾਂਜੀ ਹਾਂਜੀ ਮੈਂ ਸ਼ਾਮ ਤੱਕ ਕੋ ਕੋਸ਼ਿਸ਼ ਕਰਾਂਗੀ ਕਿ ਮੈਂ ਆਜਾ ਤੁਹਾਡੇ ਕੋਲ ਅਤੇ ਬੁੱਕਸ ਲੈ ਲਵਾਂ ਤੁਹਾਡੇ ਕੋਲ ਨੋਬਲ ਵਗੈਰਾ ਵੀ ਅਵੇਲੇਬਲ ਹੈ ਹਾਂਜੀ ਪਤਾ ਹੀ ਨਹੀਂ ਸੀ ਇੰਗਲਿਸ਼ ਲਿਟ ਲਿਟਰੇਚਰ ਦੀਆਂ ਵਗੈਰਾ ਹੁੰਦੇ ਹੈ ਓਕੇ ਚਲੋ ਫਿਰ ਠੀਕ ਹੈ ਮੈਂ ਸ਼ਾਮ ਤੱਕ ਆਉਂਂਦੀ ਹਾਂ ਹਾਂਜੀ ਬਾਕੀ ਐ ਓਕੇ ਓਕੇ ਓਕੇ ਬਾਏ ਓਕੇ